ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੁਸੀਂ ਆਪਣਾ ਮਾਸਕ ਪਾਓ ਜਿਵੇਂ ਕਿ ਤੁਹਾਨੂੰ ਪਤਾ ਹੈ ਪਤਾ ਹੀ ਹੈ ਕੋਰੋਨਾ ਮਹਾਂਮਾਰੀ ਚੱਲ ਰਹੀ ਹੈ ਉਸ ਵਿੱਚ ਸਾਰਿਆਂ ਨੂੰ ਮਾਸਕ ਪਾਉਣੇ ਜ਼ਰੂਰੀ ਹਨ ਅਸੀਂ ਤਾਂ ਜਾਣਾ ਵੀ ਚੰਡੀਗੜ੍ਹ ਹੈ ਜਿੱਥੇ ਓਹ ਬਿਨਾਂ ਮਾਸਕ ਵਾਲਿਆਂ ਨੂੰ ਚੰਡੀਗੜ੍ਹ ਐਂਟਰ ਨਹੀਂ ਹੋਣ ਦਿੰਦੇ ਚਲਾਨ ਕਰ ਦਿੰਦੇ ਹਨ ਕਿਰਪਾ ਕਰਕੇ ਤੁਸੀਂ ਮਾਸਕ ਪਾ ਲਓ ਤਾਂ ਜੋ ਸਾਨੂੰ ਕੋਈ ਦਿੱਕਤ ਨਾ ਆਵੇ ਧੰਨਵਾਦ ਜੀ